ਅਜੀਤ ਜਗ ਬਾਣੀ ਪੰਜਾਬੀ ਟ੍ਰਿਬਿਉਨ ਪੰਜਾਬੀ ਜਾਗਰਣ ਜੀ ਨਿਊਜ਼ ਪੀ ਟੀ ਸੀ ਨਿਊਜ਼ ਐੱਨ ਡੀ ਟੀ ਵੀ ਆਜ ਤੱਕ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਐੱਨ ਡੀ ਟੀ ਵੀ ਵਾਲਾ ਰਵੀਸ਼ ਸ਼ਰਮਾ ਦਾ ਪ੍ਰਾਈਮ ਸ਼ੋ ਸ਼ੋਅ ਬਹੁਤ ਪਸੰਦ ਹੈ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਜੋ ਰਵੀਸ਼ ਕੁਮਾਰ ਦਾ ਪਰਾ ਸ਼ੋਅ ਆਉਂਦਾ ਐੱਨ ਡੀ ਟੀ ਵੀ ਵਾਲਾ ਉਹਦੇ ਵਿੱਚੋਂ ਸਭ ਕੁਛ ਪੂਰੀ ਸੱਚਾਈ ਹੁੰਦੀ ਆ ਕੋਈ ਫੇਕ ਨਹੀਂ ਹੁੰਦਾ ਰਵੀਸ਼ ਕੁਮਾਰ ਦੇ ਐੱਨ ਡੀ ਟੀ ਵੀ ਵਾਲੇ ਚੈਨਲ 'ਤੇ ਹਰ ਇੱਕ ਸਾਨੂੰ ਜੋ ਵੀ ਖਬਰ ਮਿਲਦੀ ਹੈ ਟਾਈਮ ਟੂ ਟਾਈਮ ਬਿਲਕੁਲ ਸਹੀ ਮਿਲਦੀ ਆ ਕੋਈ ਉਹਦੇ ਵਿੱਚ ਝੂਠ ਨਹੀਂ ਹੁੰਦਾ ਕਿਉਂਕਿ ਜੋ ਬਾਕੀ ਰਿਪੋਰਟਰ ਨੇ ਬਾਕੀ ਚੈਨਲ ਨੇ ਉਹ ਥੋੜ੍ਹੀ ਜਿਹੀ ਗੱਲ ਨੂੰ ਬਹੁਤ ਵਧਾ ਚੜ੍ਹਾ ਕੇ ਦੱਸਦੇ ਨੇ ਪਰ ਜੋ ਰਵੀਸ਼ ਕੁਮਾਰ ਦਾ ਸ਼ੋਅ ਹੈ ਉਹਦੇ ਵਿੱਚ ਜਿਹੜੀ ਸਾਨੂੰ ਖਬਰ ਮਿਲਦੀ ਆ ਉਹ ਬਿਲਕੁਲ ਸਹੀ ਮਿਲਦੀ ਆ ਕੋਈ ਉਹਦੇ ਵਿੱਚ ਗਲਤ ਨਹੀਂ ਹੁੰਦਾ ਕਿਉਂਕਿ ਬਾਕੀ ਜੋ ਮੀਡੀਆ ਹੈ ਉਹ ਥੋੜ੍ਹੀ ਥੋੜ੍ਹੀ ਦੀ ਗੱਲ ਦਾ ਬਹੁਤ ਜ਼ਿਆਦਾ ਪ੍ਰਚਾਰ ਕਰਦੇ ਨੇ ਗੱਲ ਕੁਛ ਵੀ ਨਹੀਂ ਹੁੰਦੀ ਇਸ਼ੂ ਕੋਈ ਵੀ ਨਹੀਂ ਹੁੰਦਾ ਪਰ ਥੋੜ੍ਹੇ ਜਿਹੇ ਇਸ਼ੂ ਦਾ ਇੰਨਾ ਵੱਡਾ ਇਸ਼ੂ ਬਣ ਜਾਂਦਾ ਜਿਵੇਂ ਕਿ ਅੰਮ੍ਰਿਤਪਾਲ ਦਾ ਮੁੱਦਾ ਸੀ ਅੰਮ੍ਰਿਤਪਾਲ ਦੇ ਖਬਰਾਂ ਦੇ ਵਿੱਚ ਉਸ ਨੇ ਬਿਲਕੁਲ ਸੱਚਾਈ ਦਿਖਾਈ ਆ ਕੋਈ ਉਹਨੇ ਝੂਠ ਨਹੀਂ ਦਿਖਾਇਆ ਕੋਈ ਉਹਨੇ ਫੇਕ ਨਹੀਂ ਦਿਖਾਇਆ ਸਭ ਬਿਲਕੁਲ ਜੋ ਵੀ ਖਬਰ ਮਿਲੀ ਹੈ ਸਾਨੂੰ ਸਹੀ ਮਿਲੀ ਹੈ